ਖੇਡਣ ਨਾਲ ਮਨੁੱਖਤ ਦੇ ਜੀਵਨ ਜਾਂ ਲੋਕਾਂ ਦੇ ਜੀਵਨ 'ਤੇ ਸਮੁੱਚੇ ਗੁਣਵੱਤਾ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈਗਾ ਹੈ ਇਹਦੇ ਵਿੱਚ ਮੇਰੇ ਕੁਝ ਵਿਚਾਰ ਹੈਗੇ ਹੈ ਜਿੱਦਾਂ ਇਹਦੇ ਨਾਲ ਬੰਦਾ ਅਗਵਾਈ ਚੰਗੀ ਅਗਵਾਈ ਕਰਨੀ ਸਿੱਖਦਾ ਹੈਗਾ ਹੈ ਉਹਦੇ ਵਿੱਚ ਚੰਗੀ ਅਗਵਾਈ ਕਰਨ ਦੇ ਵਧੀਆ ਗੁਣ ਪੈਦਾ ਹੁੰਦੇ ਹੈਗੇ ਹੈ ਕਿਸ ਕਿਸੇ ਵੀ ਪ੍ਰੋਬਲਮ ਨਾਲ ਉਹਨੂੰ ਕਿੱਦਾਂ ਉਹਨੂੰ ਨਜਿੱਠਣਾ ਕਿੱਦਾਂ ਉਹਦੇ ਨਾਲ ਉਹਨੂੰ ਡੀਲ ਕਰਨਾ ਇਹ ਸਾਰੇ ਗੁਣ ਉਹਨੂੰ ਪਤਾ ਲੱਗਦੇ ਹੈਗੇ ਹੈ ਉਹ ਇਕੱਠੇ ਰਹਿਣਾ ਸਿੱਖਦੇ ਹੈਗੇ ਹੈ ਤੰਦਰੁਸਤ ਸਰੀਰ ਮਿਲਦਾ ਹੈਗਾ ਉਹਨੂੰ ਜਿਹੜੀ ਸਾਰਿਆ ਨਾਲੋਂ ਬੜੀ ਗੱਲ ਹੈਗੀ ਹੈ ਉਹਦੇ ਨਾਲ ਜਿਹੜਾ ਚੰਗਾ ਉਹਦਾ ਵਧੀਆ ਮਾਨਸਿਕ ਵਿਕਾਸ ਹੁੰਦਾ ਹੈਗਾ ਉਹਦਾ ਜਿਹੜੇ ਸਰੀਰ ਦੇ ਗੰਦੇ ਪਾ ਉਹ ਹੁੰਦਾ ਹੈਗਾ ਗੰਦੇ ਜਿਹੜੇ ਕੈਮੀਕਲ ਹੁੰਦੇ ਸਰੀਰ ਦੇ ਉਹ ਪਸੀਨੇ ਰਾਹੀਂ ਬਾਹਰ ਨਿਕਲਦੇ ਹੈਗੇ ਹੈ ਇਸ ਕਰਕੇ ਜਿੱਦਾਂ ਹੁਣ ਬੰਦਾ ਫੁੱਟਬਾਲ ਖੇਡਦਾ ਹੈਗਾ ਫੁੱਟਬਾਲ ਖੇਡਣ ਨਾਲ ਇੱਕ ਤਾਂ ਉਹਦੀ ਚੰਗੀ ਅਤੇ ਯੋਗ ਅਗਵਾਈ ਕਰਨ ਦਾ ਬੰਦਾ ਯੋਗ ਬਣ ਜਾਂਦਾ ਹੈਗਾ ਹੈ ਜਿਹੜੇ ਉਹ ਇਕੱਠੇ ਰਹਿਣਾ ਸਿੱਖਦੇ ਮਤਲਬ ਇਕੱਠੇ ਰਹਿੰਦੇ ਹੈਗੇ ਹੈ ਮਿਲ ਜੁਲ ਕੇ ਰਹਿਣ ਦੀ ਭਾਵਨਾ ਸਹਿਣਸ਼ੀਲਤਾ ਦੀ ਭਾਵਨਾ ਅਨੁਸ਼ਾਸਨ 'ਚ ਰਹਿੰਦਾ ਹੈਗਾ ਹੈ ਬੰਦਾ ਅਤੇ ਦੂਜਿਆਂ ਨਾਲ ਮਿਲ ਜੁਲ ਕੇ ਰਹਿਣ ਦੇ ਇੱਦਾਂ ਦੇ ਬਹੁਤ ਸਾਰੇ ਇਹ ਤੋਂ ਇਲਾਵਾ ਹੋਰ ਵੀ ਗੁਣ ਬੰਦੇ 'ਚ ਵਿਕਸਿਤ ਹੁੰਦੇ ਹੈਗੇ ਹੈ